ਪੰਜਾਬ ਰਾਜ ਵਿੱਚ ਮੁੱਖ ਰੁਝਾਨ ਹੁਣ ਜ਼ਿਆਦਾ ਜਿਹੜਾ ਆ ਉਹ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵੱਲ ਜ਼ਿਆਦਾ ਹੋ ਗਿਆ ਆ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਪਹਿਲਾਂ ਪੰਜਾਬੀ ਮੀਡੀਅਮ ਵਾਲੇ ਸਕੂਲਾਂ ਵਿੱਚ ਵੀ ਪੜ੍ਹਾਈ ਜਿਹੜੀ ਆ ਉਹ ਉਹਨੂੰ ਕਰਨ ਨੂੰ ਲੋਕ ਤਰਜੀਹ ਦਿੰਦੇ ਸੀ ਕੋਈ ਹੀਣਤਾ ਨਹੀਂ ਸੀ ਸਮਝਦੇ ਹੁਣ ਲੋਕੀ ਪੰਜਾਬੀ ਮੀਡੀਅਮ 'ਚ ਪੜਨ ਨੂੰ ਹੀਣਤਾ ਸਮਝਦੇ ਆ ਉਹ ਸਮਝਦੇ ਨੇ ਕਿ ਅੰਗਰੇਜ਼ੀ ਮੀਡੀਅਮ 'ਚ ਪੜ੍ਹਿਆ ਬੱਚਾ ਹੀ ਮਹਾਨ ਬਣ ਸਕਦਾ ਹੈ ਅਤੇ ਹਰ ਕੋਈ ਆਪਣੇ ਬੱਚੇ ਨੂੰ ਅੰਗਰੇਜ਼ੀ ਮੀਡੀਅਮ ਦੇ ਸਕੂਲਾਂ ਦੇ ਵਿੱਚ ਪਾਉਣਾ ਚਾਹੁੰਦਾ ਹੈ ਹੋਰ ਇੱਕ ਰੁਝਾਨ ਬਾਹਰ ਜਾਣ ਦਾ ਕਰਕੇ ਬੱਚੇ ਜਿਹੜੇ ਆ ਵੀ ਕਹਿੰਦੇ ਆ ਪਲੱਸ ਟੂ ਪੜ੍ਹੋ ਉਹਨਾਂ ਦਾ ਕੋਈ ਸਿੱਖਿਆ ਵੱਲ ਉਹਨਾਂ ਦਾ ਧਿਆਨ ਨਹੀਂ ਸਿਰਫ਼ ਸਰਟੀਫਿਕੇਟਾਂ ਵੱਲ ਧਿਆਨ ਆ ਵੀ ਪਲੱਸ ਟੂ ਕਰੋ ਅਤੇ ਆਇਲਸ ਕਰੋ ਅਤੇ ਬਾਹਰ ਨੂੰ ਚੱਲ ਜਾਓ ਇਹੋ ਹੀ ਜ਼ਿਆਦਾ ਰੁਝਾਨ ਹੋ ਗਿਆ ਸਿੱਖਿਆ ਵੱਲ ਨਹੀਂ ਸਰਟੀਫਿਕੇਟਾਂ ਵੱਲ ਧਿਆਨ ਹੋ ਗਿਆ ਅਤੇ ਬ ਇਹ ਬਦਲਾਅ ਨੇ ਔਨਲਾਈਨ ਕਲਾਸਾਂ ਕਰੋਨਾ ਦੇ ਵਿੱਚ ਦਿੱਤੀਆਂ ਗਈਆਂ ਸਕੂਲਾਂ ਦੇ ਵਿੱਚ ਚਲੋ ਜਿਹੜੇ ਵੱਡੇ ਬੱਚੇ ਨੇ ਉਹਨਾਂ ਨੇ ਤਾਂ ਔਨਲਾਈਨ ਕਲਾਸਾਂ 'ਚ ਕੁਛ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਦਾ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਕੁਝ ਸੀਰੀਅਸ ਬੱਚੇ ਜਾਂ ਪੇਰੈਂਟਸ ਜਿਹੜੇ ਇਨਵੋਲਡ ਸੀਗੇ ਉਹ ਤਾਂ ਪੜ੍ਹੇ ਅਤੇ ਜਿਹੜੇ ਬੱਚੇ ਇਕੱਲੇ ਫੋਨ ਲੈ ਕੇ ਬਹਿ ਗਏ ਉਹ ਪੜ੍ਹੇ ਕਿ ਨਹੀਂ ਪੜ੍ਹੇ ਪਰ ਉਹਨਾਂ ਨੇ ਫੋਨ ਚਲਾਉਣੇ ਜਰੂਰ ਸਿੱਖ ਲਏ ਨੇ ਖੇਡਾਂ ਗੇਮਾਂ ਔਨਲਾਈਨ ਗੇਮਾਂ ਜਿਹੜੀਆਂ ਫੋਨਾਂ 'ਤੇ ਉਹ ਖੇਡਣੀਆਂ ਸਿੱਖ ਗਏ ਆ ਅਤੇ ਸਿੱਖਿਆ ਤੋਂ ਕਿਤਾਬਾਂ ਤੋਂ ਹੋਰ ਦੂਰ ਹੋ ਗਏ ਨੇ ਬੱਚੇ ਕਿਤਾਬਾਂ ਤੋਂ ਬਹੁਤ ਦੂਰ ਨੇ ਅੱਜ ਦੇ ਹਾਂ ਕੁਝ ਕਿ ਇਹ ਆ ਇੱਕ ਚੰਗੀ ਗੱਲ ਇਹ ਵੀ ਆ ਕਿ ਪਹਿਲਾਂ ਸਿਰਫ਼ ਕਿਤਾਬੀ ਗਿਆਨ ਸੀ ਜਿਹੜਾ ਵਾ ਉਹਨੂੰ ਸਿੱਖਿਆ ਸਮਝਿਆ ਜਾਂਦਾ ਸੀ ਵੀ ਬੀਐੱਸਸੀ ਕਰ ਲਓ ਅਤੇ ਬੀਕੌਮ ਕਰ ਲਓ ਅਤੇ ਐੱਮਕੌਮ ਕਰ ਲਓ ਅਤੇ ਐੱਮਐੱਸਸੀ ਕਰ ਲਓ ਹੁਣ ਥੋੜ੍ਹਾ ਜਿਹਾ ਬੱਚਿਆਂ ਨੂੰ ਜਾਣਕਾਰੀ ਹੋਈ ਆ ਹੁਣ ਉਹ ਜਿਹੜੇ ਆ ਕਿੱਤਾ ਮੁਖੀ ਕੋਰਸਾਂ ਵੱਲ ਨੂੰ ਜਾ ਰਹੇ ਨੇ ਟੈਕਨੀਕਲ ਐਜੂਕੇਸ਼ਨ ਨੂੰ ਪਰੈਫਰ ਕਰ ਰਹੇ ਨੇ ਇਹ ਇੱਕ ਚੰਗੀ ਗੱਲ ਆ ਅਤੇ ਟੈਕਨੀਕਲ ਕੋਲਜ ਵੀ ਕਾਫ਼ੀ ਹੋ ਗਏ ਨੇ ਪਹਿਲਾਂ ਇੰਨੇ ਕੋਲਜ ਵੀ ਨਹੀਂ ਸੀ ਹੁੰਦੇ ਹੁਣ ਕੋਲਜ ਵੀ ਕਾਫ਼ੀ ਹੋ ਗਏ ਅਤੇ ਬੱਚਿਆਂ ਨੂੰ ਜਾਣਕਾਰੀ ਵੀ ਆ ਕੁਝ ਜਿਹੜੀ ਆ ਵੱਧਦੀ ਹੋਈ ਟੈਕਨੋਲਜੀ ਦਾ ਫ਼ਾਇਦਾ ਵੀ ਆ ਪਈ ਹੁਣ ਹਰ ਇੱਕ ਕੋਲ ਜਾਣਕਾਰੀ ਹੈ ਕੋਈ ਬੰਦਾ ਘਰ ਬਹਿ ਕੇ ਔਨਲਾਈਨ ਕੋਰਸ ਵੀ ਕਰ ਸਕਦਾ ਜਿਹੜੇ ਵੀ ਕਿੱਤੇ ਦੇ ਵਿੱਚ ਉਹ ਕੋਰਸ ਕਰਨਾ ਚਾਹੇ ਇਹ ਅ ਕੁਝ ਪਲੱਸ ਪੁਆਇੰਟ ਵੀ ਹੈਗੇ ਆ ਕੁਝ ਮਾਈਨਸ ਵੀ ਹੈਗੇ ਆ ਬਈ ਕਿਤਾਬਾਂ ਤੋਂ ਜਿਹੜਾ ਵਾ ਉਹ ਬੱਚੇ ਦੂਰ ਹੋ ਗਏ ਨੇ ਪਰ ਹਾਂ ਗਿਆਨ ਦੀ ਗੰਗਾ ਵੱਗ ਰਹੀ ਹੈ ਚਾਹੇ ਔਨਲਾਈਨ ਚਾਹੇ ਔਫਲਾਈਨ ਬੱਚੇ ਫਿਰ ਵੀ ਬਹੁਤ ਕੁਛ ਸਿੱਖ ਰਹੇ ਨੇ